ਨਮਸਤੇ ਮੇਰਾ ਨਾਮ ਸੋਨੀਕਾ ਮੈਂ ਗੁਰਦਾਸਪੁਰ ਤੋਂ ਰਹਿਣ ਵਾਲੀ ਹਾਂ ਅਤੇ ਅਸੀਂ ਅੱਜ ਪਾਣੀ ਦੇ ਬਾਰੇ ਗੱਲ ਕਰਾਂਗੇ ਜਿਸ ਤਰ੍ਹਾਂ ਕਿ ਪਾਣੀ ਵੀ ਮਤਲਬ ਕਿ ਸਾਨੂੰ ਪਾਣੀ ਕਿਸੇ ਤਰ੍ਹਾਂ ਦਾ ਪੀਣਾ ਚਾਹੀਦਾ ਪਾਣੀ ਸਾਨੂੰ ਸਾਫ ਪੀਣਾ ਚਾਹੀਦਾ ਜਿਹਦੇ ਨਾਲ ਮਤਲਬ ਕਿ ਕਿਵੇਂ ਦਾ ਜਿੱਦਾਂ ਲੋਕਾਂ ਦੇ ਘਰਾਂ 'ਚ ਵਾਟਰ ਸਪਲਾਈ ਦਾ ਪਾਣੀ ਬਹੁਤ ਗੰਦਾ ਆਉਂਦਾ ਅਤੇ ਜਿਹੜਾ ਗੰਦਾ ਪਾਣੀ ਪੀ ਕੇ ਕਈ ਲੋਕ ਬਿਮਾਰ ਵੀ ਹੋ ਜਾਂਦੇ ਨੇ ਜਿੱਦਾਂ ਸੀਵਰੇਜ ਦੀਆਂ ਪਾਈਪਾਂ ਉਹਦੇ ਨਾਲ ਵੀ ਮਤਲਬ ਕਿ ਅਟੈਚ ਹੁੰਦੀਆਂ ਨੇ ਪਰ ਸਾਨੂੰ ਉਹ ਪਾਣੀ ਨਹੀਂ ਪੀਣਾ ਚਾਹੀਦਾ ਕਈ ਘਰਾਂ 'ਚ ਐਰ ਓ ਵਗੈਰਾ ਲੱਗੇ ਹੁੰਦੇ ਆ ਪਰ ਨਹੀ ਮਤਲਬ ਕਿ ਜਿਹੜੇ ਲੋਕ ਵਿਚਾਰੇ ਆਰ ਓ ਨਹੀਂ ਲਗਵਾ ਸਕਦੇ ਸਮਸਰੀਵੱਲ ਨਹੀਂ ਲਗਵਾ ਸਕਦੇ ਉਹਨਾਂ ਦਾ ਗੰਦੇ ਪਾਣੀ ਕਟਰ ਵਗੈਰਾ ਨਾਲ ਅ ਹੁੰਦਾ ਵਾ ਉਹਦੇ ਆਪਣੇ ਗੰਦੇ ਪਾਣੀ ਨਾਲ ਦੇ ਸਮੈਲ ਵੀ ਬਹੁਤ ਆਉਂਦੀ ਹੈ ਅਤੇ ਗੰਦੇ ਪਾਣੀ ਨਾਲ ਤਾਂ ਮਤਲਬ ਕਿ ਕੱਪੜੇ ਵਗੈਰਾ ਵੀ ਨਹੀਂ ਵਾਸ਼ ਨਹੀ ਕਰ ਸਕਦੇ ਬਰਤਨ ਸਾਫ ਨਹੀਂ ਕਰ ਸਕਦੇ ਅਤੇ ਇਹਦੇ ਨਾਲ ਮਤਲਬ ਕਿ ਉਹਨਾਂ ਨੂੰ ਬਿਮਾਰੀਆਂ ਵੀ ਲੱਗਣ ਦਾ ਡਰ ਕਿਸੇ ਨੂੰ ਇਨਫੈਕਸ਼ਨ ਹੋ ਜਾਂਦੀ ਹੈ ਗੰਦੇ ਪਾਣੀ ਤੋਂ ਕਈਆਂ ਨੂੰ ਮਤਲਬ ਕਿ ਬਿਮਾਰ ਹੋ ਜਾਂਦੇ ਆ ਲੂਜ ਮੋਜ਼ਨ ਮੋਸ਼ਨ ਵਗੈਰਾ ਲੱਗ ਜਾਂਦੇ ਆ ਅਤੇ ਇਸ ਕਰਕੇ ਪਾਣੀ ਨੂੰ ਉਬਾਲ ਕੇ ਅਤੇ ਮਤਲਬ ਕਿ ਉਹਨੂੰ ਸ਼ੁੱਧ ਬਣਾ ਕੇ ਪੀਣਾ ਚਾਹੀਦਾ ਜਿਹਦੇ ਨਾਲ ਮਤਲਬ ਕਿ ਲੋਕਾਂ ਨੂੰ ਬਿਮਾਰੀਆਂ ਵਗੈਰਾ ਨਹੀਂ ਲੱਗਣ ਅਤੇ ਇਹਦੇ ਨਾਲ ਕਿ ਇਹ ਕਮੇਟੀ ਇੱਕ ਸਾਡੇ ਪੰਜਾਬ ਵਿੱਚ ਪਾਣੀ ਬਹੁਤ ਗੰਦਾ ਆਉਂਦਾ ਇਹਦੇ ਕਰਕੇ ਅਸੀਂ ਕਮੇਟੀ ਘਰ ਜਾ ਕੇ ਐ ਮਹੱਲਾ ਮੀਟਿੰਗ ਵਗੈਰਾ ਕਰਦੇ ਹਾਂ ਉਹਦੇ ਨਾਲ ਅਸੀਂ ਇੱਕ ਮਤਲਬ ਕਿ ਐਪਲੀਕੇਸ਼ਨ ਲਿਖ ਕੇ ਦਿੰਦੇ ਹਾਂ ਜਿਹਦੇ ਨਾਲ ਪਾਣੀ ਸਾਫ ਹੋ ਜਾਏ ਅਤੇ ਇਸ ਨਾਲ ਮਤਲਬ ਕਿ ਲੋਕਾਂ ਦੇ ਜਿਹੜੇ ਸੀਵਰੇਜ ਦੀਆਂ ਪਾਈਪਾਂ ਉਹ ਇਕੱਠੀਆਂ ਹੋ ਜਾਂਦੀਆਂ ਵਾ ਤਾਂ ਕਰਕੇ ਲੋਕਾਂ ਦਾ ਪਾਣੀ ਗੰਦਾ ਸਰਕਾਰ ਸੁਣਵਾਈ ਨਹੀਂ ਹੁੰਦੀ ਅਤੇ ਉਹਦੇ ਨਾਲ ਮਤਲਬ ਕਿ ਕਈ ਤਰ੍ਹਾਂ ਦੀ ਬਿਮਾਰੀਆਂ ਲੋਕਾਂ ਦੀ ਲੱਗ ਜਾਂਦੀਆਂ ਅਸੀਂ ਉਹ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਫਿਰ ਲੋਕ ਪਾਣੀ ਉਬਾਲ ਕੇ ਪੀਂਦੇ ਪੀਂਦੇ ਹਨ ਪਰ ਕਈ ਲੋਕ ਤਾਂ ਮਤਲਬ ਕਿ ਜਿੱਦਾਂ ਬਿਮਾਰ ਹੋਣ 'ਤੇ ਉਹਦੇ ਵਿੱਚ ਘੋਲ ਬਣਾ ਕੇ ਵੀ ਪੀਂਦੇ ਹਨ ਜਿਹਦੇ ਵਿੱਚ ਛੇ ਮਤਲਬ ਕਿ ਛੇ ਚਮਚ ਚੀਨੀ ਔਰ ਇੱਕ ਚਮਚ ਨਮਕ ਦਾ ਪਾ ਕੇ ਪੀਤਾ ਜਾਂਦਾ ਅਤੇ ਆਪਣੀ ਟੈਂਕੀ ਵਿੱਚ ਵੀ ਇੱਕ ਇੱਕ ਦਵਾਈ ਆਉਂਦੀ ਹੈ ਰੈਡ ਕਲਰ ਦੀ ਉਹ ਆਪਣੀ ਟੈਂਕੀ 'ਚ ਵੀ ਪੰਜ ਸੱਤ ਬੂੰਦਾਂ ਪਾ ਦਿੰਦੇ ਹਨ ਪਰ ਜਿਹਦੇ ਨਾਲ ਉਹ ਪਾਣੀ ਸਾਫ ਹੋ ਜਾਂਦਾ ਹੈ